ਹਾਂ ਸਾਡੇ ਪਿੰਡ ਵਿੱਚ ਬਹੁਤ ਕੰਮ ਨੇ ਜੀ ਕੰਮ ਕਰਨ ਵਾਲਾ ਚਾਹੀਦਾ ਸਾਡੇ ਪਿੰਡ ਵਿੱਚ ਬਹੁਤ ਰੁਜ਼ਗਾਰ ਹੈਗਾ ਫੈਕਟਰੀਆਂ ਨੇ ਕੰਮ ਫੈਕਟਰੀਆਂ ਦੇ ਵਿੱਚ ਕੰਮ ਹੈ ਜਨਾਨੀਆਂ ਵਾਸਤੇ ਬੰਦਿਆਂ ਵਾਸਤੇ ਵੀ ਜਨਾਨੀਆਂ ਕੰਮ ਕਰਦੀਆਂ ਨੇ ਗੀਆਂ ਜਿਵੇਂ ਡੀਮਾਰਟ ਦੇ ਵਿੱਚ ਕੰਮ ਕਰਦੀਆਂ ਨੇ ਕਿਸੇ ਨੂੰ ਉੱਥੇ ਝਾੜੂ ਪੋਚੇ ਦਾ ਕੰਮ ਮਿਲਿਆ ਹੋਇਆ ਕੋਈ ਸਮਾਨ ਸਪਲਾਈ ਕਰਦੀ ਹੈ ਕੋਈ ਕਾਊਂਟਰ 'ਤੇ ਬੈਠੀ ਹੈ ਪਰਚੀਆਂ ਕੱਟ ਰਹੀ ਹੈ ਕੋਈ ਜਾਣਕਾਰੀ ਦਿੰਦੀ ਹੈ ਇੱਥੇ ਆਹ ਸਮਾਨ ਪਿਆ ਕੋਈ ਇੱਥੇ ਆਹ ਸਾਮਾਨ ਪਿਆ ਜੀ ਬਾਕੀ ਸਾਡੇ ਇੱਥੇ ਭਾਂਡੇ ਦੀ ਫੈਕਟਰੀ ਹੈ ਉੱਥੇ ਵੀ ਔਰਤਾਂ ਕੰਮ ਕਰਦੀਆਂ ਨੇ ਜੀ ਕੋਈ ਭਾਂਡੇ ਸਾਫ਼ ਕਰਦੀ ਹੈ

ਔਰਤਾਂ ਦਾ ਟੈਮ ਸਪੈਂਡ ਹੋ ਜਾਂਦਾ ਹੈ ਸਿਲਾਈ ਕਢਾਈ ਦਾ ਕੰਮ ਕਰਦੀਆਂ ਨੇ ਜੀ ਸਿਲਾਈ ਦਾ ਕੰਮ ਆਮ ਘਰਾਂ ਦੇ ਵਿੱਚ ਕੀਤਾ ਜਾਂਦਾ ਹੈਗਾ ਆਮ ਜਨਰੇਸ਼ਨ ਕੱਪੜੇ ਸਿਲਾ ਕੇ ਪਾਈ ਜਾਂਦੀ ਹੈ ਉਹਦੇ ਵਿੱਚ ਸਿਲਾਈ ਦਾ ਕੰਮ ਆ ਜਾਂਦਾ ਔਰਤਾਂ ਘਰੇ ਸਿਲਾਈ ਦਾ ਕੰਮ ਕਰਦੀਆਂ ਨੇ ਆਪਦਾ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਕੇ ਸਿਲਾਈ ਦਾ ਕੰਮ ਕਰਦੀਆਂ ਨੇ ਗੀਆਂ ਨਾਲੇ ਤਾਂ ਰੁਜ਼ਗਾਰ ਮਿਲ ਜਾਂਦਾ ਜੀ ਨਾਲੇ ਟੈਮ ਪਾਸ ਹੋ ਜਾਂਦਾ ਹੈ ਨਾਲੇ ਆਪਦੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਘਰੇ ਕੰਮ ਕਰ ਕਰ ਕੇ ਅਤੇ ਸਾਡੇ ਕੰਮ ਵਿੱਚ ਪਿੰਡ ਵਿੱਚ ਬਹੁਤ ਕੰਮ ਨੇ ਜੀ ਜੋ ਵੀ ਬਾਹਰੋਂ ਆਉਂਦੇ ਨੇ ਉਹ ਵੀ ਇੱਥੇ ਆ ਕੇ ਕੰਮ ਕਰਨ ਲੱਗ ਜਾਂਦੇ ਨੇ ਗੇ ਇੰਨੇ ਕੰਮ ਨੇ ਸਾਡੇ ਪਿੰਡ ਦੇ ਵਿੱਚ ਡੀਮਾਰਟ ਹੈ ਉੱਥੇ ਕੰਮ ਹੈ ਜੀ ਆਊਟਲੈਟ ਹੈ ਉੱਥੇ ਕੰਮ ਹੈ ਜੀ ਉੱਥੇ ਵੀ ਔਰਤਾਂ ਕੰਮ ਕਰਦੀਆਂ ਕੋਈ ਕੱਪੜੇ ਦੀ ਦੁਕਾਨ 'ਤੇ ਕੰਮ ਕਰਦੀ ਹੈ ਕੋਈ ਹੋਟਲ ਵਿੱਚ ਕੰਮ ਕਰਦੀ ਹੈ ਕੋਈ ਕਿਤੇ ਕੰਮ ਕਰਦੀ ਹੈ ਕੋਈ ਕਿਤੇ ਕੰਮ ਕਰਦੀ ਹੈ ਸਭ ਦਾ ਟੈਮ ਸਪੈਂਡ ਹੋ ਜਾਂਦਾ ਜੀ